ਅੱਜ ਦੇ ਸਮੇਂ ਵਿੱਚ ਪੜ੍ਹਾਈ ਵਿੱਚ ਰੁੱਝੇ ਰਹਿਣ ਕਰਕੇ ਮੈਨੂੰ ਆਪਣੇ ਸ਼ਹਿਰ ਤੋਂ ਬਾਹਰ ਘੁੰਮਣ ਦਾ ਮੌਕਾ ਨਹੀਂ ਮਿਲਿਆ ਪਰ ਅੱਜ ਤੋਂ ਤਿੰਨ ਸਾਲ ਪਹਿਲਾਂ ਮੈਂ ਅਤੇ ਮੇਰਾ ਪਰਿਵਾਰ ਘੁੰਮਣ ਗਿਆ ਸੀ ਜੋ ਕਿ ਬਹੁਤ ਹੀ ਮਨਪਸੰਦ ਮੇਰਾ ਐਕਸਪੀਰੀਅੰਸ ਰਿਹਾ ਮੈਂ ਛੁੱਟੀਆਂ ਗਰਮੀ ਦੀ ਛੁੱਟੀਆਂ ਵਿੱਚ ਵੀ ਵੈਸ਼ਨੋ ਦੇਵੀ ਮਾਤਾ ਦੇ ਦਰਸ਼ਨ ਕਰਨ ਲਈ ਸਲਾਹ ਕੀਤੀ ਅਤੇ ਮੇਰੇ ਘਰ ਦੇ ਮੰਨ ਗਏ ਜਦੋਂ ਉਹਨਾਂ ਨੇ ਟਿਕਟਾਂ ਬੁੱਕ ਕਰਵਾਈਆਂ ਤਾਂ ਪਤਾ ਲੱਗਾ ਸਾਡੀ ਟਰੇਨ ਰਾਤ ਦੀ ਹੈ ਰਾਤ ਨੂੰ ਅਸੀਂ ਟਰੇਨ ਵਿੱਚ ਬੈਠੇ ਅਤੇ ਅਗਲੀ ਸਵੇਰ ਮਾਤਾ ਰਾਣੀ ਦੇ ਦਰਸ਼ਨ ਕਰਨ ਲਈ ਕੱਟੜਾ ਪਹੁੰਚ ਗਏ ਕੱਟੜਾ ਜਾ ਕੇ ਅਸੀਂ ਹੋਟਲ ਬੁੱਕ ਕੀਤਾ ਅਤੇ ਫਰੈਸ਼ ਫਰੂਸ਼ ਨਹਾ ਧੋ ਕੇ ਮਾਤਾ ਰਾਣੀ ਦੇ ਦਰਸ਼ਨ ਕਰਨ ਲਈ ਨਿਕਲ ਪਏ ਮਾਤਾ ਰਾਣੀ ਦੇ ਦਰਸ਼ਨ ਕਰਨ ਲਈ ਬਹੁਤ ਲੰਬੀ ਚੜ੍ਹਾਈ ਸੀਗੀ ਅਤੇ ਮੇਰੇ ਭੈਣ ਭਾਈ ਫਟਾਫਟ ਚੜ੍ਹ ਗਏ ਅਤੇ ਮੈਂ ਥੱਕ ਗਈ ਅਤੇ ਮੇਰੇ ਮਾਤਾ ਪਿਤਾ ਵੀ ਚੜ੍ਹ ਰਹੇ ਸਨ ਉਹਨਾਂ ਨੂੰ ਦੇਖ ਕੇ ਮੈਨੂੰ ਬਹੁਤ ਹਿੰਮਤ ਮਿਲੀ ਅਤੇ ਮੈਂ ਵੀ ਚੜ੍ਹ ਗਈ ਅਤੇ ਮੈਂ ਉੱਥੋਂ ਬਹੁਤ ਹੀ ਚੀਜ਼ਾਂ ਲਿਤੀਆਂ ਜੋ ਕਿ ਮੈਨੂੰ ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਦੀ ਯਾਦ ਜਤਾਏ ਮੈਂ ਉੱਥੋਂ ਪ੍ਰਸ਼ਾਦ ਲਿੱਤਾ ਅਤੇ ਕੁਝ ਆਪਣੇ ਲਈ ਸਮਾਨ ਲਿਤਾ ਜਿਵੇਂ ਕਿ ਹੱਥਾਂ ਵਿੱਚ ਪਾਉਣ ਵਾਲੀ ਚੂੜੀਆਂ ਇਹ ਐਕਸਪੀਰੀਅੰਸ ਮੇਰੇ ਲਈ ਬਹੁਤ ਹੀ ਚੰਗਾ ਸੀ ਅਗਰ ਇਨ ਫਿਊਚਰ ਮੈਨੂੰ ਇਹ ਮੌਕਾ ਦੁਬਾਰਾ ਮਿਲੇ ਤਾਂ ਮੈਂ ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਲਈ ਜ਼ਰੂਰ ਜਾਣਾ ਚਾਹਵਾਂਗੀ